ਸਾਡੇ ਖੇਤਰ ਦੇ ਵਿੱਚ ਜਿਹੜੀ ਕਿ ਕਲਾ ਬਾਜੀ ਹੈ ਇੱਕ ਡਿਜ਼ਾਇਨਰ ਕਲਾ ਬਾਜੀ ਹੈ ਹੱਥੀ ਕਲਾ ਬਾਜੀ ਹੈ ਜਿਹੜੀਆਂ ਫਾਏ ਡਿਜ਼ਾਇਨਰ ਜਾਂ ਆ ਗਿਆ ਜਦੋਂ ਹੱਥੀ ਕੋਈ ਚੀਜ਼ਾਂ ਤਿਆਰ ਕੀਤੀਆਂ ਨੇ ਉਹ ਇਸ ਤਰ੍ਹਾਂ ਦੂਜੇ ਖੇਤਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਵੇਂ ਕਿ ਸਾਡੇ ਗੁਰਦੁਆਰਾ ਸਾਹਿਬ ਜਿਵੇਂ ਕਿ ਮਹਿਤੇਆਣਾ ਸਾਹਿਬ ਆ ਗਿਆ ਜਾਂ ਵਿਰਾਸਤ ਏ ਖਾਲਸਾ ਅਨੰਦਪੁਰ ਆ ਗਿਆ ਉੱਥੇ ਹੁਣ ਕੀ ਹੈ ਵੀ ਹੱਥੀਂ ਜਿਹੜੀਆਂ ਮੂਰਤੀਆਂ ਤਿਆਰ ਕਰੀਆਂ ਹੈ ਨਾ ਉਹ ਇੱਕ ਇਹ ਲੱਗਦਾ ਸਾਡੇ ਇਤਿਹਾਸ ਨਾਲ ਰਿਲੇਟਡ ਹੈ ਵੀ ਕਿਵੇਂ ਸਾਡੇ ਜਿਹੜੇ ਗੁਰੂ ਸੀਗੇ ਸਿੱਖ ਸਾਹਿਬਾਨ ਸੀਗੇ ਉਹਨਾਂ ਨੇ ਜੰਗਾਂ ਲੜੀਆਂ ਉਹਨਾਂ ਦੀਆਂ ਜੰਗਾਂ ਲੜਦਿਆਂ ਦੀਆਂ ਜਾਂ ਜਿਹੜੀਆਂ ਸ਼ਹੀਦੀਆਂ ਪਾਈਆਂ ਨੇ ਚੜਖੜੀਆ 'ਤੇ ਚੜ੍ਹ ਕੇ ਜਾਂ ਕਿਸੇ ਤਰ੍ਹਾਂ ਹੋਰ ਵੀ ਉਹ ਉਹਨਾਂ ਦੀਆਂ ਹੱਥੀਂ ਮੂਰਤੀਆਂ ਬਣਾਈਆਂ ਹੋਈਆਂ ਉਹਨਾਂ ਦੀ ਡਿਜਾਨਿੰਗ ਆ ਜਿਹੜੀ ਉਹ ਹੱਥੀਂ ਕੀਤੀ ਹੋਈ ਹੈ ਉਹਨਾਂ ਦੇ ਬੁੱਤ ਬਣਾਏ ਗਏ ਨੇ ਪੂਰੇ ਵਧੀਆ ਉਹ ਦੇਖਣ 'ਚ ਇਹ ਲੱਗਦਾ ਵੀ ਇਹ ਸੱਚੀ ਮੁੱਚੀ ਬਣੇ ਹੋਏ ਨੇ ਬਹੁਤ ਵਧੀਆ ਲੱਗਦੇ ਨੇ ਵਿਰਾਸਤ ਏ ਖਾਲਸਾ ਨੂੰ ਦੇਖੀ ਜਾਈਏ ਕਿ ਜਦੋਂ ਉਹ ਪੂਰੀਆਂ ਚੀਜ਼ਾਂ ਉਵੇਂ ਹੀ ਜੰਗਾਂ ਲੜਦੇ ਦਿਖਾਈ ਜਾਂਦੇ ਆ ਉਹ 'ਚੋਂ ਬਣੇ ਵੈਸੇ ਹੱਥੀਂ ਨੇ ਪਰ ਲੜਦੀਆਂ ਦਿਖਾਉਂਦੇ ਆ ਉਹਦੇ ਵਿੱਚ ਉਹ ਉਸ ਤਰ੍ਹਾਂ ਵੀ ਉਹ ਵਿਰਾਸਤ ਏ ਖਾਲਸਾ ਦੇ ਵਿੱਚ ਜਾਨੀ ਕਿ ਬਹੁਤ ਵਧੀਆ ਲੱਗਦੀਆਂ ਨੇ ਅਤੇ ਚੱਪੜ ਚਿੜੀ ਲਾ ਲਓ ਮੋਹਾਲੀ ਦੇ ਵਿੱਚ ਉਹ ਵੀ ਇੱਕ ਜਿਹੜਾ ਕਿ ਬੰਦਾ ਬਹਾਦਰ ਦੀ ਚੱਪੜ ਚਿੜੀ ਬਣਾਈ ਹੋਈ ਉੱਥੇ ਉਹ ਸਾਰੇ ਸ਼ਹੀਦ ਜਿਹੜੇ ਸਿੰਘ ਸ਼ਹੀਦ ਸੀ ਉਹਨਾਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਨੇ ਉਹ ਇੱਕ ਕਲਾ ਬਾਜੀ ਹੈ ਡਿਜ਼ਾਇਨਿੰਗ ਹੈ ਉਹ ਬਹੁਤ ਸੋਹਣੀਆਂ ਲੱਗਦੀਆਂ ਨੇ ਖੂਬ ਲੱਗਦੀਆਂ ਨੇ ਸਾਡੇ ਇਤਿਹਾਸ ਨੂੰ ਵੀ ਦੂਜੇ ਖੇਤਰਾਂ ਦੇ ਨਾਲੋਂ ਬਹੁਤ ਸੋਹਣੀਆਂ ਜਾਨੀ ਕਿ ਕਲਾ ਬਾਜੀ ਦਿਖਾਈ ਗਈ ਉੱਥੇ ਦੂਜੇ ਖੇਤਰਾਂ ਨਾਲੋਂ ਸਾਡਾ ਖੇਤਰ ਜਿਹੜਾ ਉਹ ਉਸ ਚੀਜ਼ਾਂ ਨੂੰ ਪ੍ਰਭਾਵਿਤ ਕਰਦਾ ਗਾ ਅਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਹ ਫਿਲਮਾਂ ਦੀ ਫ਼ਿਲਮਾਂ ਦਾ ਕਰੇਜ਼ ਵੈਸੇ ਹੈਗਾ ਗਾ ਪਰ ਅੱਗੇ ਨਾਲੋਂ ਕੁਛ ਘੱਟਦਾ ਜਾ ਰਿਹਾ ਕਿਉਂਕਿ ਵੈਬ ਸੀਰੀਜ਼ ਜਿਹੜੀਆਂ ਚੱਲ ਵੈਬ ਸੀਰੀਜ਼ ਕਾਫੀ ਕਾਫੀ ਆਉਂਦੀਆਂ ਨੇ ਹੈ ਨਾ ਤੀਹ ਤੀਹ ਪੈਂਤੀ ਪੈਂਤੀ ਜਾਂ ਇਸ ਤੋਂ ਵੀ ਵੱਧ ਹੁੰਦੀਆਂ ਨੇ ਉਸ ਦੇ ਵਿੱਚ ਜਿਹੜੀਆਂ ਕਿ ਵੀ ਕਾਲਜ ਦੀਆਂ ਵੈਬ ਸੀਰੀਜਾਂ ਦਿਖਾਈਆਂ ਜਾਂਦੀਆਂ ਜਾਂ ਹੋਰ ਦਿਖਾਈਆ ਜਾਂਦੀਆਂ ਵੈਬ ਸੀਰੀਜ਼ ਨੈਟਫਲੈਕਸ 'ਤੇ ਕਾਫੀ ਚੱਲਦੀਆਂ ਨੇ ਅਤੇ ਇਸ ਤਰ੍ਹਾਂ ਵੀ ਜਿਹੜਾ ਕੋਈ ਫਿਲਮਾਂ ਦਾ ਕਰੇਜ ਥੋੜ੍ਹਾ ਜਿਹਾ ਘੱਟਦਾ ਜਾਂਦਾ ਵੈਬ ਸੀਰੀਜ਼ ਨੂੰ ਥੋੜ੍ਹਾ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇ ਪੀੜ੍ਹੀ ਹੈਗੀ ਉਹ ਦੇਖਣਾ ਪਸੰਦ ਕਰਦੀ ਆ ਫਿਲਮਾਂ ਦਾ ਕਰੇਜ ਆਪਦੀ ਜਗ੍ਹਾ ਗਾ ਵੈਬ ਸੀਰੀਜ਼ ਦਾ ਜਿਹੜਾ ਉਹ ਆਪ ਦੀ ਜਗ੍ਹਾ ਗਾ ਅਤੇ ਇਸ ਤਰ੍ਹਾਂ ਜਿਹੜਾ ਕਿ ਸਾਡਾ ਵੀ ਫਿਲਮਾਂ ਦਾ ਹੈਗਾ ਉਹ ਕਰੇਜ਼ ਵੀ ਥੋੜ੍ਹਾ ਜਿਹਾ ਅੱਗੇ ਨਾਲੋਂ ਵੈਬ ਸੀਰੀਜ਼ ਦੀ ਤਰ੍ਹਾਂ ਵੀ ਘੱਟ ਹੈ ਵੈਬ ਸੀਰੀਜ਼ ਥੋੜ੍ਹਾ ਜ਼ਿਆਦਾ ਚੱਲ ਰਹੀ ਹੈ